ਜੀ ਹਾਂ ਸਾਨੂੰ ਸਭ ਨੂੰ ਪਤਾ ਹੈ ਕਿ ਪਿਛਲੇ ਸਾਲਾਂ ਵਿੱਚ ਮਨੋਰੰਜਨ ਬਹੁਤ ਹੀ ਚੰਗਾ ਹੁੰਦਾ ਸੀ ਜਿੱਦਾਂ ਕਿ ਇਹ ਪੁਰਾਣੇ ਬਜ਼ੁਰਗ ਇੱਕ ਦੂਜੇ ਨਾਲ ਬੈਠ ਕੇ ਸ਼ਾਮ ਵੇਲੇ ਗੀਤ ਗਾਉਂਦੀਆਂ ਸਨ ਬਜ਼ੁਰਗ ਬ ਬਜ਼ੁਰਗ ਇਕ ਪਿੱਪਲ ਥੱਲੇ ਬੈਠ ਕੇ ਗਪ ਗੱਲਾਂ ਬਾਤਾਂ ਕਰਦੇ ਸਨ ਬਜ਼ੁਰਗਨੀਆਂ ਬੁੱਢੀਆਂ ਮਾਵਾਂ ਧੀ ਧੀਆਂ ਰਲ ਮਿਲ ਕੇ ਗੀਤ ਗਾਉਂਦੀਆਂ ਸਨ ਅਤੇ ਆਪਣਾ ਆਪਣਾ ਕੰਮ ਕਰਦੀਆਂ ਸਨ ਸ਼ਾਮ ਦੇ ਸਮੇਂ ਸਾਰੇ ਆਪਣੇ ਆਪਣੇ ਘਰਾਂ ਦੇ ਕੰਮ ਕਰਕੇ ਬਾਹਰ ਨਿਕਲਦੇ ਸਨ ਤਾਂ ਉਹ ਬੱਚੇ ਬਜ਼ੁਰਗ ਵੱਡੇ ਸਭ ਬੈਠ ਕੇ ਗੱਲਾਂ ਬਾਤਾਂ ਕਰਦੇ ਸਨ ਬੱਚੇ ਖੇਡਦੇ ਸਨ ਮ ਬੁੱਢੀਆਂ ਗੀਤ ਗਾਉਂਦੀਆਂ ਸਨ ਬੱਚੀਆਂ ਕਿੱਕਲੀ ਗੀ ਕਿੱਕਲੀ ਕਰਦੀਆਂ ਅਤੇ ਨੱਚਦੀਆਂ ਟੱਪਦੀਆਂ ਸਨ ਜੋ ਕਿ ਇਸ ਸਮੇਂ ਦੇ ਬਦਲਣ ਨਾਲ ਪਹਿਲਾਂ ਤਾਂ ਟੀਵੀ ਰੇਡੀਓ ਜਦੋਂ ਕਿ ਪਹਿਲਾਂ ਦਾ ਸਮਾਂ ਸੀਗਾ ਉਦੋਂ ਰੋ ਰੇਡੀਓ ਚਲਦੇ ਸਨ ਰੇਡੀਓ ਵੀ ਸ਼ਾਮ ਦੇ ਟਾਈਮ ਲੋਕ ਆਪਣੇ ਘਰਾਂ ਦੇ ਵਿੱਚ ਲਗਾ ਕੇ ਸੁਣਦੇ ਸਨ ਫਿਰ ਟੀਵੀ ਆਇਆ ਟੀਵੀ ਨੇ ਵੀ ਬੱਚਿਆਂ ਦੇ ਮਨ ਨੂੰ ਬਹੁਤ ਹੀ ਪਰੇਸ਼ਾਨ ਅਤੇ ਖੇਡਾਂ ਨੂੰ ਖੋਹ ਲਿਆ ਹੈ ਜਿੱਦਾਂ ਕਿ ਹੁਣ ਦੇ ਸਮੇਂ ਵਿੱਚ ਕੰਪਿਊਟਰ ਅਤੇ ਮੋਬਾਈਲ ਫੋਨ ਇਲੈਕਟਰੋਨਿਕ ਗੈਜਟ ਨੇ ਆਪਣੀ ਸਥਾਨ ਇੰਨੀ ਜ਼ਿਆਦਾ ਬਣਾ ਲਈ ਹੈ ਕਿ ਜਿੱਦਾਂ ਕਿ ਪੁਰਾਣੀਆਂ ਗੇਮਾਂ ਕਬੱਡੀ ਖੋ ਖੋ ਕ੍ਰਿਕਟ ਲੁੱਡੀ ਗੱਟਾ ਗੱਲੀ ਆਦਿ ਦੀਆਂ ਖੇਡਾਂ ਹਨ ਜੋ ਕਿ ਬੱਚਿਆਂ ਨੂੰ ਅੱਜ ਕੱਲ੍ਹ ਦੇ ਸਮੇਂ ਵਿੱਚ ਨਹੀਂ ਪਤਾ ਉਹਨਾਂ ਨੂੰ ਸਿਰਫ ਮੋਬਾਈਲ ਦੇ ਵਿੱਚ ਗੇਮਾਂ ਵੀਡੀਓ ਗੇਮਾਂ ਗੈਜਟ ਦੇ ਵਿੱਚ ਗੇਮ ਕੰਪਿਊਟਰ ਆਦਿ ਦੀਆਂ ਸਭ ਗੱਲਾਂ ਪਤਾ ਹਨ ਇਹ ਇਸਦਾ ਕਾਰਨ ਇਹ ਹੈ ਕਿ ਸਰਕਾਰ ਨੂੰ ਇਹ ਸਭ ਚੀਜ਼ਾਂ ਥੋੜ੍ਹੇ ਟਾਈਮ ਲਈ ਬੰਦ ਕਰਨ ਲਈ ਕਹਿਣਾ ਚਾਹੀਦਾ ਹੈ ਅਤੇ ਪੁਰਾਣੀਆਂ ਗੇਮਾਂ ਨੂੰ ਫਿਰ ਤੋਂ ਦੁਬਾਰਾ ਵਾਪਸ ਲੈ ਕੇ ਆਉਣਾ ਚਾਹੀਦਾ ਹੈ ਬੱਚਿਆਂ ਦੇ ਦਿਲ ਵਿੱਚ ਪੁਰਾਣੀ ਆਪਣੇ ਪੁਰਾਣੇ ਸਮਾਜ ਆਪਣੇ ਪੁਰਾਣੇ ਭਾਰਤ ਦੀਆਂ ਗੱਲਾਂ ਵੀ ਸਮਝਾਉਣੀਆਂ ਚਾਹੀਦੀਆਂ ਹਨ ਜਿੱਦਾਂ ਕਿ ਪੁਰਾਣੇ ਬਜ਼ੁਰਗ ਖੇਡਦੇ ਹੁੰਦੇ ਗੁੱਲੀ ਡੰਡਾ ਕਬੱਡੀ ਖੋ ਖੋ ਇਹ ਪੁਰਾਣੀਆਂ ਖੇਡਾਂ ਬੱਚਿਆਂ ਨੂੰ ਦੱਸਣੀਆਂ ਚਾਹੀਦੀਆਂ ਹਨ ਜੋ ਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਬੱਚਿਆਂ ਨੂੰ ਨਹੀਂ ਪਤਾ